ਸਤਿ ਸ਼੍ਰੀ ਅਕਾਲ ਮੈਂ ਕਿਰਨਦੀਪ ਕੌਰ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਔਰ ਮੇਰੇ ਖਿਆਲ ਦੇ ਹਿਸਾਬ ਨਾਲ ਸਾਡੇ ਰਾਜ ਦੀ ਸੱਭਿਆਚਾਰਕ ਪਛਾਣ ਵਿੱਚ ਪੰਜਾਬੀ ਭਾਸ਼ਾ ਦਾ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਹੈ ਪੰਜਾਬੀ ਸਾਡੀ ਪਹਿਚਾਣ ਹੈ ਸਾਡੀ ਭਾਸ਼ਾ ਤੋਂ ਹੀ ਸਾਡੇ ਸਾਡੇ ਬਾਰੇ ਸਾਡੇ ਆ ਆਪ ਨੂੰ ਦਰਸਾਉਂਦੀ ਹੈ ਇਹਦੇ ਨਾਲ ਸਾਡੀ ਰਹਿਣੀ ਬਹਿਣੀ ਉੱਠਣੀ ਬੋਲਚਾਲ ਦੇ ਥਰੂ ਹੀ ਸਾਡਾ ਸੁਭਾਅ ਪਤਾ ਲੱਗਦਾ ਹੈ ਪੰਜਾਬ ਦੇ ਲੋਕਾਂ ਦਾ ਪੰਜਾਬੀ ਦੇ ਨਾਲ ਇਕ ਬਹੁਤ ਹੀ ਪੁਰਾਣਾ ਅਤੇ ਗਹਿਰਾ ਰਿਸ਼ਤਾ ਹੈ ਅਸੀਂ ਆਪਣੀ ਮਾਤਰ ਭਾਸ਼ਾ ਦੇ ਥਰੂ ਆਪਣੇ ਅੰਦਰੋਂ ਜੋ ਵੀ ਸਾਡੇ ਪੁਰਾਣੇ ਰੀਤੀ ਰਿਵਾਜ ਸਭ ਕੁਛ ਸਾਡੀ ਭਾਸ਼ਾ ਦੇ ਥਰੂ ਦਰਸਾਉਂਦੀ ਹੈ ਕਿਉਂਕਿ ਗੱਲਬਾਤ ਕਰਨ ਦੇ ਤਰੀਕੇ ਤੋਂ ਹੀ ਪਤਾ ਚੱਲ ਸਕਦਾ ਹੈ ਕਿ ਸਾਡੇ ਅਸੀਂ ਕਿਸ ਤਰ੍ਹਾਂ ਦੀ ਜਗ੍ਹਾ ਤੋਂ ਬਿਲੋਂਗ ਕਰਦੇ ਹਾਂ ਔਰ ਪੰਜਾਬੀ ਭਾਸ਼ਾ ਦਾ ਇਹਦੇ ਵਿੱਚ ਬਹੁਤ ਮਹੱਤਵਪੂਰਨ ਲੋ ਰੋਲ ਹੈ ਅਸੀਂ ਆਪਣਾ ਜਿੰਨਾ ਹੀ ਮਿੱਟੀ ਨਾਲ ਜੁੜੇ ਹੋਵਾਂਗੇ ਓਨੀ ਜ਼ਿਆਦਾ ਪੰਜਾਬੀ ਭਾਸ਼ਾ ਨੂੰ ਬੋਲ ਸਕਦੇ ਹਾਂ ਸੋ ਇਸ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੀ ਭੂਮਿਕਾ ਇੱਕ ਬਹੁਤ ਹੀ ਵਧੀਆ ਰੋਲ ਨਿਭਾਉਂਦੀ ਹੈ ਸਾਡੇ ਇਸ ਤੋਂ ਇਲਾਵਾ ਸਾਡਾ ਖਾਣਾ ਪੀਣਾ ਔਰ ਰਹਿਣਾ ਸਹਿਣਾ ਔਰ ਪਹਿਰਾਵਾ ਇਹ ਵੀ ਸਾਡੀ ਪੰਜਾਬੀਅਤ ਨੂੰ ਦਰਸਾਉਂਦਾ ਹੈ ਖਾਣ ਪੀਣ ਤੋਂ ਪੰਜਾਬੀਆਂ ਦੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਦਿਖਾਉਂਦੇ ਹੈ ਪੰਜਾਬ ਦੇ ਲੋਕ ਖਾਣੇ ਪੀਣੇ ਦੇ ਲਈ ਆਪਣੀ ਕਿਸਾਨੀ ਦੇ ਲਈ ਅਸੀਂ ਫ਼ਸਲਾਂ ਉਗਾਉਂਦੇ ਹਾਂ ਫ਼ੂਡ ਦਿੰਦੇ ਹਾਂ ਸੋ ਕੱਪੜਿਆਂ ਤੋਂ ਸਾਡੇ ਪ੍ਰੋਫੈਸ਼ਨ ਦੀ ਸਾਰੇ ਪੰਜਾਬੀ ਭਾਸ਼ਾ ਦੇ ਥਰੂ ਹੀ ਪਤਾ ਲੱਗਦਾ ਹੈ ਸੋ ਇਹਦੇ ਥਰੂ ਮੈਂ ਇਹੀ ਦੱਸਣਾ ਚਾਹੰਦੀ ਹਾਂ ਕਿ ਪੰਜਾਬ ਪੰਜਾਬੀਅਤ ਇੱਕ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੇ ਨੇ ਪੂਰੇ ਦੇਸ਼ ਦੇ ਲਈ ਪੰਜਾਬੀਆਂ ਦੀ ਵੱਖਰੀ ਪਛਾਣ ਹੈ ਪੂਰੇ ਸੰਸਾਰ ਦੇ ਵਿੱਚ ਉਨ੍ਹਾਂ ਦੇ ਭਾਸ਼ਾ ਦੇ ਨਾਲ ਉਨ੍ਹਾਂ ਦੇ ਪਹਿਰਾਵੇ ਦੇ ਨਾਲ ਉਨ੍ਹਾਂ ਦੇ ਖਾਣੇ ਪੀਣੇ ਦੇ ਨਾਲ ਉਨ੍ਹਾਂ ਦੇ ਖੇਤੀਬਾੜੀ ਦੇ ਨਾਲ